ਮੈਨੂੰ ਪੇਂਟਿੰਗ ਕਰਨਾ ਬਹੁਤ ਪਸੰਦ ਹੈ ਪੇਂਟਿੰਗ ਕਰਨਾ ਮੇਰਾ ਬਚਪਨ ਤੋਂ ਹੀ ਸ਼ੌਂਕ ਰਿਹਾ ਹੈ ਮੈਂ ਬਚਪਨ ਤੋਂ ਹੀ ਪੇਂਟਿੰਗ ਕਰਦਾ ਆ ਰਿਹਾ ਹਾਂ ਪਹਿਲਾਂ ਮੈੈਂ ਜ਼ਿਆਦਾ ਵਧੀਆ ਪੇਂਟਿੰਗ ਨਹੀਂ ਕਰ ਪਾਉਂਦਾ ਸੀ ਪਰ ਮੈਂ ਹੁਣ ਹੌਲੀ ਹੌਲੀ ਆਪਣੀ ਪੇਂਟਿੰਗ ਵਿੱਚ ਬਹੁਤ ਜ਼ਿਆਦਾ ਸੁਧਾਰ ਕੀਤਾ ਹੈ ਹੁਣ ਤੱਕ ਹੁਣ ਮੈਂ ਬਹੁਤ ਵਧੀਆ ਪੇਂਟਿੰਗ ਬਣਾ ਲੈਂਦਾ ਹਾਂ ਮੈਂ ਬਹੁਤ ਮਿਹਨਤ ਕੀਤੀ ਹੈ ਤੇ ਹੁਣ ਮੇਰੀ ਮਿਹਨਤ ਰੰਗ ਲੈ ਕੇ ਆਈ ਹੈ ਮੇਰੀਆਂ ਬਣਾਈਆ ਪੇਂਟਿੰਗਾਂ ਬਜ਼ਾਰਾਂ ਵਿੱਚ ਵਧੀਆ ਕੀਮਤ ਤੇ ਵਿਕ ਰਹੀਆਂ ਹਨ ਮੈਨੂੰ ਹਰ ਸਮੇਂ ਪੇਂਟਿੰਗ ਵਿੱਚ ਰੁੱਝੇ ਰਹਿਣਾ ਬਹੁਤ ਪਸੰਦ ਹੈ ਮੈਂ ਕਾਲਜ ਵਿੱਚ ਪੜਦਾ ਹਾਂ ਤੇ ਜਦੋਂ ਵੀ ਕਾਲਜ ਕਾਲਜ ਵਿੱਚ ਪੇਂਟਿੰਗ ਮੁਕਾਬਲਾ ਹੁੰਦਾ ਹੈ ਤਾਂ ਮੈਂ ਉਸ ਵਿੱਚ ਵੱਧ ਚੜ ਕੇ ਹਿੱਸਾ ਲੈਂਦਾ ਹਾਂ ਤੇ ਇਸ ਵਿੱਚੋਂ ਮੇਰੀਆਂ ਬਹੁਤ ਪੁਜ਼ੀਸ਼ਨਾਂ ਵੀ ਆਈਆਂ ਹਨ ਪੇਂਟਿੰਗ ਕਰਨ ਲਈ ਮੇਰਾ ਸਭ ਤੋਂ ਪਸੰਦੀਦਾ ਵਿਸ਼ਾ ਕੁਦਰਤ ਦੇ ਅਦਭੁਵ ਨਜ਼ਰੇ ਹਨ ਮੈਨੂੰ ਕੁਦਰਤ ਦੀ ਗੋਦ ਵਿੱਚ ਬੈਠ ਕੇ ਪੇਂਟਿੰਗ ਕਰਨਾ ਬਹੁਤ ਵਧਈਆ ਲੱਗਦਾ ਹੈ ਮੈਂ ਕੁਦਰਤ ਦੇ ਬਣਾਏ ਨਜ਼ਰਿਆ ਨੂੰ ਦੇਖਦਾ ਹਾਂ ਅਤੇ ਉਹਨਾਂ ਨੂੰ ਆਪਣੀ ਪੇਂਟਿੰਗ ਤੇ ਤਰਾਸ਼ਦਾ ਰਹਿੰਦਾ ਹੈ ਮੈਨੂੰ ਪੌਦਿਆਂ ਪੰਛੀਆਂ ਅਤੇ ਅਲੱਗ ਅਲੱਗ ਪ੍ਰਾਜਾਤੀਆ ਦੀ ਪੇਂਟਿੰਗ ਬਣਾਉਣਾ ਬਹੁਤ ਪਸੰਦ ਹੈ ਪੇਂਟਿੰਗ ਮੇਰੀ ਜ਼ਿੰਦਗੀ ਦਾ ਇੱਕ ਅਨਮੋਲ ਹਿੱਸਾ ਬਣ ਗਈ ਹੈ